ਮੇਰਾ ਸੈਮਸੰਗ ਦਾ ਮੋਬਾਈਲ ਜੋ ਕਿ ਮੈਂ ਕੀਮਤ ਪੰਦਰਾਂ ਹਜ਼ਾਰ ਰੁਪਏ ਦੇ ਵਿੱਚ ਲਿੱਤਾ ਸੀ ਜਦੋਂ ਫ਼ੋਨ ਮੈਂ ਯੂਸ ਕਰਦਾ ਤਾਂ ਇਹਦਾ ਕੈਮਰਾ ਯੂਸ ਕਰਦਾ ਬਹੁਤ ਹੀ ਘਟੀਆ ਕੁਆਲਿਟੀ ਫ਼ੋਨ ਦੀ ਕੈਮਰੇ ਦੀ ਹੈ ਔਰ ਬੈਟਰੀ ਬੈਕਅੱਪ ਬਹੁਤ ਹੀ ਘਟੀਆ ਹੈ ਜਿੰਨੇ ਕੰਪਨੀ ਨੇ ਪੈਸੇ ਲਿਤੇ ਸੀ ਉਸ ਚੀਜ਼ ਦਾ ਮੁੱਲ ਫ਼ੋਨ ਨਹੀਂ ਮੋੜ ਸਕਿਆ ਅਤੇ ਬੈਟਰੀ ਐਨੀ ਜ਼ਿਆਦਾ ਖਰਾਬ ਕਰਦੀ ਹੈ ਕਿ ਵਾਰ ਵਾਰ ਚਾਰਜ ਕਰਨਾ ਪੈਂਦਾ ਹੈ ਅਤੇ ਫਿਰ ਚਾਰਜ ਕਰਨ ਦੇ ਨਾਲ ਜੈੱਕ ਖਰਾਬ ਹੁੰਦਾ ਹੈ ਇੱਕ ਦਿਨ ਮੇਰੀ ਜੇਬ ਦੇ ਵਿੱਚ ਪਿਆ ਪਿਆ ਫ਼ੋਨ ਆਟੋਮੈਟਿਕ ਸਕਰੀਨ ਕਰੈਕ ਹੋ ਗਈ ਹੈ ਬਹੁਤ ਜ਼ਿਆਦਾ ਜਿਸਦੇ ਕਾਰਨ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਝੱਲਣੀ ਪਈ ਹੈ